ਹੈਲੋ ਹਾਂਜੀ ਨਮਸਕਾਰ ਜੀ ਰੈਸਟੋਰੈਂਟ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਮੈਂ ਰਾਜੀਵ ਸੁਖੀਜਾ ਬੋਲ ਰਿਹਾ ਸਰ ਮੈਂ ਨਾ ਤੁਹਾਡੇ ਰੈਸਟੋਰੈਂਟ 'ਚ ਸ਼ਾਮ ਨੂੰ ਇੱਕ ਪਾਰਟੀ ਕਰਨੀ ਹੈ ਜਿਸ ਵਿੱਚ ਮੇਰੇ ਕਰੀਬ ਪੰਦਰਾਂ ਕੁ ਫਰੈਂਡ ਨੇ ਆਉਣਾ ਤਾਂ ਮੈਂ ਕਨਫਰਮ ਕਰਨਾ ਸੀ ਵੀ ਕੀ ਕੀ ਮਤਲਬ ਸਮਾਨ ਮਿਲੇਗਾ ਖਾਣ ਪੀਣ ਵਾਸਤੇ ਡਿਨਰ 'ਚ ਕੀ ਹੋਏਗਾ ਟੇਬਲ ਉੱਥੇ ਮਿਲੇਗਾ ਕਿ ਨਹੀਂ ਮਿਲੇਗਾ ਅਤੇ ਪਾਰਕਿੰਗ ਕਿਸ ਤਰ੍ਹਾਂ ਹੋਏਗੀ ਪਾਰਕਿੰਗ ਕਾਰ ਪਾਰਕਿੰਗ ਇਜ਼ਲੀ ਲੱਗ ਜਾਣਗੀਆਂ ਕਿਉਂਕਿ ਪੰਦਰਾਂ ਜਾਣੇ ਆ ਤਾਂ ਦੋ ਦੋ ਵੀ ਅਗਰ ਆਉਣ ਤਾਂ ਅਪ੍ਰੋਕਸੀਮੈਟ ਸੱਤ ਅੱਠ ਕਾਰ ਹੋ ਜਾਣਗੀਆਂ ਉਹਦੇ ਲਈ ਪਾਰਕਿੰਗ ਸਹੀ ਲੱਗ ਕੇ ਫਿਰ ਅੰਦਰ ਪ੍ਰੋਪਰ ਐਂਟਰੀ ਕਿਸ ਤਰ੍ਹਾਂ ਹੋਏਗੀ ਸਭ ਦੀ ਇਸ ਤਰ੍ਹਾਂ ਐਂਟਰੀ ਹੋ ਜਾਵੇਗੀ ਜਾਂ ਕੋਈ ਪਾਸਿਸ ਵਗੈਰਾ ਲੈਣੇ ਪੈਣਗੇ ਪਹਿਲਾਂ ਅਤੇ ਬੰਦ ਕਿੰਨੇ ਕੁ ਵਜੇ ਤੱਕ ਹੋ ਜਾਵੇਗਾ ਤੁਸੀਂ ਰਾਤ ਨੂੰ ਅੱਠ ਕੁ ਵਜੇ ਅਗਰ ਇਕੱਠੇ ਹੋਈਏ ਤਾਂ ਅਸੀਂ ਬਹੁਤ ਸਾਲਾਂ ਬਾਅਦ ਇਕੱਠੇ ਹੋ ਰਹੇ ਹਾਂ ਸਾਰੇ ਫਰੈਂਡਸ ਤਾਂ ਵੀ ਤਿੰਨ ਚਾਰ ਘੰਟੇ ਸਾਨੂੰ ਲੱਗ ਜਾਣਗੇ ਅਸੀਂ ਜੋ ਡਿਨਰ ਵੀ ਲੈਣਾ ਸਨੈਕਸ ਵੀ ਲਵਾਂਗੇ ਡਿਨਰ ਵੀ ਲਵਾਂਗੇ ਫਿਰ ਕੋਲਡਰਿੰਕ ਵਗੈਰਾ ਵੀ ਬਾਅਦ 'ਚ ਹੋ ਜਾਣਗੇ ਮਿੱਠਾ ਵੀ ਹੋਏਗਾ ਤਾਂ ਉਹ ਸਾਰਾ ਕਰਨ 'ਤੇ ਤਾਂ ਨਾਲ ਮੈਨੂੰ ਇਹ ਵੀ ਦੱਸੋ ਵੀ ਕਿੰਨਾ ਕੁ ਟਾਈਮ ਕਿੰਨੀ ਕੁ ਵਜੇ ਤੱਕ ਇਹ ਰੈਸਟੋਰੈਂਟ ਬੰਦ ਹੋਏਗਾ